ਹੈਲੋ ਸਵੀਗੀ ਤੋਂ ਗੱਲ ਕਰਦੇ ਪਏ ਹੋ ਮੈਂ ਸਰਬਜੀਤ ਕੌਰ ਜੋ ਕਿ ਮੈਂ ਤੁਹਾਡੀ ਵੈੱਬਸਾਈਟ ਤੋਂ ਔਡਰ ਕੀਤਾ ਹੋਇਆ ਸੀ ਔਡਰ ਦੇ ਵਿੱਚ ਦੋ ਬਰਗਰ ਦੋ ਪੀਜ਼ੇ ਸੀ ਔਡਰ ਆਇਆ ਤਾਂ ਹੈ ਸੀ ਪਰ ਮੈਂ ਘਰ ਵਿੱਚ ਨਹੀਂ ਸਾਂ ਜਿਸ ਕਰਕੇ ਉਹ ਔਡਰ ਨੂੰ ਮੈਂ ਰਿਸੀਵ ਨਹੀਂ ਕਰ ਸਕੀ ਫਿਰ ਮੈਂ ਉਹ ਔਡਰ ਕੈਂਸਲ ਕਰ ਦਿੱਤਾ ਪਰ ਉਹ ਰਿਫ ਕੈਂਸਲ ਕੀਤੇ ਔਡਰ ਦਾ ਰਿਫੰਡ ਅਜੇ ਤੱਕ ਮੇਰੇ ਅਕੋਂਟ ਵਿੱਚ ਨਹੀਂ ਆਇਆ ਇਸ ਕਰਕੇ ਤੁਸੀਂ ਦੱਸੋ ਕਿ ਇਹ ਕਿੰਨੇ ਦਿਨ ਵਿੱਚ ਵਾਪਸ ਆਵੇਗਾ ਤੁਸੀਂ ਪਹਿਲਾਂ ਪੰਜ ਦਿਨ ਵਿੱਚ ਕਿਹਾ ਸੀ ਅੱਜ ਦਸ ਦਿਨ ਹੋ ਗਏ ਹੈ ਅਤੇ ਅਜੇ ਤੱਕ ਰਿਫੰਡ ਵਾਪਸ ਨਹੀਂ ਆਇਆ ਹੁਣ ਤੁਸੀਂ ਦੱਸੋ ਕਿ ਤੁਹਾਡੀ ਰੈਪੋਟੀਸ਼ਨ ਵਿੱਚ ਕਿੰਨਾ ਫਰਕ ਪਵੇਗਾ ਅੱਗੇ ਤੋਂ ਮੈਂ ਤੁਹਾਡੀ ਵੈਬਸਾਈਟ ਤੋਂ ਕੋਈ ਵੀ ਚੀਜ਼ ਨਹੀਂ ਮੰਗਵਾਵਾਂਗੀ ਕਿਰਪਾ ਕਰਕੇ ਮੇਰਾ ਜਲਦੀ ਤੋਂ ਜਲਦੀ ਰਿਫੰਡ ਵਾਪਸ ਕਰ ਦਿੱਤਾ ਜਾਵੇ ਨਹੀਂ ਤਾਂ ਮੈਂ ਅੱਗੇ ਤੋਂ ਤੁਹਾਡੀ ਵੈੱਬਸਾਈਟ ਤੋਂ ਕੋਈ ਵੀ ਚੀਜ਼ ਨਹੀਂ ਮੰਗਵਾਵਾਂਗੀ